ਮੇਰਾ ਨਾਮ ਬਸੰਤ ਕੁਮਾਰ ਹੈ ਮੈਂ ਰੋਪੜ ਟੈਕਸੀ ਸਟੈਂਡ ਤੋਂ ਟੈਕਸੀ ਬੁੱਕ ਕਰਵਾਈ ਸੀ ਮੈਂ ਅਤੇ ਮੇਰੇ ਦੋਸਤਾਂ ਨੇ ਘੁੰਮਣ ਜਾਣਾ ਸੀ ਮਨਾਲੀ ਤਾਂ ਕਰਕੇ ਅਸੀਂ ਟੈਕਸੀ ਬੁੱਕ ਕਰਵਾਈ ਸੀ ਅਤੇ ਸਾਨੂੰ ਟੈਕਸੀ ਵੀ ਟਾਈਮ ਦੀ ਮਿਲ ਗਈ ਅਤੇ ਡਰਾਈਵਰ ਵੀ ਸਾਨੂੰ ਟਾਈਮ ਦਾ ਮਿਲ ਗਿਆ ਸੀਗਾ ਅਤੇ ਅਸੀਂ ਉੱਥੋਂ ਚੱਲ ਪਏ ਸੀਗੇ ਪਰ ਜਿੱਦਾਂ ਅਸੀਂ ਗੱਡੀ 'ਚ ਬੈਠੇ ਅਤੇ ਦੇਖਿਆ ਕਿ ਉਹਦੀਆਂ ਸੀਟਾਂ ਮਤਲਬ ਕਾਫੀ ਖਰਾਬ ਸੀਆਂ ਟੁ ਮਤਲਬ ਫਟੀਆਂ ਫੁਟੀਆਂ ਸੀਗੀਆਂ ਕੰਡੀਸ਼ਨ ਠੀਕ ਨਹੀਂ ਸੀ ਗੱਡੀ ਦੀ ਅਤੇ ਨਾਲ ਉਹਦੇ 'ਚੋਂ ਮਤਲਬ ਸਫਾਈ ਵੀ ਮਤਲਬ ਉਹਨਾਂ ਨੇ ਪ੍ਰੋਪਰ ਨਹੀਂ ਕੀਤੀ ਸੀ ਸਮੈੱਲ ਜੀ ਆ ਰਹੀ ਸੀ ਜਦ ਅਸੀਂ ਗੱਡੀ 'ਚ ਬੈਠੇ ਚਲੋ ਉਹ ਤਾਂ ਅਸੀਂ ਜਿੱਦਾਂ ਮਰਜ਼ੀ ਕਰਕੇ ਨਿਕਲ ਪਏ ਉੱਥੋਂ ਪਰ ਜਿੱਦਾਂ ਹੀ ਅਸੀਂ ਅੱਧਾ ਰਸਤਾ ਦੋ ਘੰਟੇ ਦਾ ਸਫਰ ਤੈਅ ਕੀਤਾ ਉਹਦੇ ਬਾਅਦ ਅੱਧੇ ਰਸਤੇ ਸਾਡਾ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਟਾਇਰ ਪੈਂਚਰ ਹੋਣ ਤੋਂ ਬਾਅਦ ਮਤਲਬ ਜਾਦੀਕਰ ਅਸੀਂ ਮਕੈਨਿਕ ਬੁਲਾਇਆ ਮਕੈਨਿਕ ਬੁਲਾਉਂਦੇ ਬੁਲਾਉਂਦੇ ਸਾਨੂੰ ਕਮ ਸੇ ਕਮ ਡੇਢ ਘੰਟਾ ਲੱਗ ਗਿਆ ਡੇਢ ਘੰਟੇ ਦੇ ਬਾਅਦ ਸਾਡੀ ਗੱਡੀ ਦਾ ਪੰਚਰ ਠੀਕ ਹੋਇਆ ਉਹਦੇ ਬਾਅਦ ਅਸੀਂ ਨਿਕਲ ਪਏ ਮਤਲਬ ਮਨਾਲੀ ਨੂੰ ਪਰ ਉਹਦੇ ਬਾਅਦ ਵੀ ਇਹ ਪ੍ਰੋਬਲਮ ਸੀਗੀ ਕਿ ਮਤਲਬ ਗੱਡੀ ਦਾ ਹੋਰਨ ਹੈ ਉਹ ਪ੍ਰੋਪਰ ਵਰਕ ਨਹੀਂ ਕਰ ਰਿਹਾ ਸੀਗਾ ਸਾਊਂਡ ਉਹਦੀ ਬਿਲਕੁਲ ਸਲੋ ਸੀਗੀ ਅਸੀਂ ਜਿੱਦਾਂ ਮਰਜ਼ੀ ਮਨਾਲੀ ਪਹੁੰਚ ਤਾਂ ਗਏ ਪਰ ਸਾਨੂੰ ਬੜੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਸਾਡਾ ਕਾਫੀ ਟਾਈਮ ਵੇਸਟ ਹੋ ਗਿਆ ਉਸ ਚੀਜ਼ ਮੇਰੀ ਤੁਹਾਨੂੰ ਇਹੀ ਰਿਕੁਐਸਟ ਹੈ ਕਿ ਅੱਗੇ ਤੋਂ ਆਪਣੀ ਇਹ ਫੈਸਲਿਟੀ ਵਿੱਚ ਸੁਧਾਰ ਕੀਤਾ ਜਾਵੇ ਤਾਂ ਕਿ ਕੱਲ੍ਹ ਨੂੰ ਕਿਸੇ ਨੂੰ ਕੋਈ ਇੱਦਾਂ ਦੀ ਪ੍ਰੋਬਲਮ ਦਾ ਸਾਹਮਣਾ ਕਰਨਾ ਨਾ ਪੈ ਜੇ ਥੈਂਕ ਯੂ